ਹਸਪਤਾਲ ਇੱਕ ਅਜਿਹੀ ਥਾਂ ਹੁੰਦੀ ਹੈ ਜਿੱਥੇ ਰੋਗੀਆਂ ਦਾ ਇਲਾਜ ਮਾਹਿਰ ਡਾਕਟਰਾਂ ਦੁਆਰਾ ਕੀਤਾ ਜਾਂਦਾ ਹੈ ਇੱਥੇ ਮਰੀਜ਼ ਦੀ ਸੇਵਾ ਅਤੇ ਸਹਾਇਤਾ ਲਈ ਨਰਸਾਂ ਵੀ ਮੌਜੂਦ ਹੁੰਦੀਆਂ ਹਨ ਹਸਪਤਾਲ ਦੋ ਵਿਭਾਗਾਂ ਵਿੱਚ ਵੰਡਿਆ ਹੁੰਦਾ ਹੈ ਪਹਿਲਾ ਵਿਭਾਗ ਓ ਪੀ ਡੀ ਹੁੰਦਾ ਹੈ ਅਤੇ ਦੂਸਰਾ ਇੰਨਡੋਰ ਵਿਭਾਗ ਹੁੰਦਾ ਹੈ ਓਟੀਬੀ ਵਿਭਾਗ ਵਿਖੇ ਸਧਾਰਨ ਬਿਮਾਰੀਆਂ ਵਾਲੇ ਮਰੀਜ਼ ਹੁੰਦੇ ਹਨ ਜੋ ਕਿ ਰੋਗੀ ਪਰਚੀ ਬਣਵਾ ਕੇ ਮਾਹਿਰ ਡਾਕਟਰਾਂ ਤੋਂ ਦਵਾਈ ਲੈਂਦੇ ਹਨ ਅਤੇ ਆਪਣੇ ਘਰ ਚਲੇ ਜਾਂਦੇ ਹਨ ਇੰਨਡੋਰ ਵਿਭਾਗ ਵਿੱਚ ਉਹਨਾਂ ਮਰੀਜ਼ਾਂ ਨੂੰ ਹੀ ਦਾਖਿਲ ਕੀਤਾ ਜਾਂਦਾ ਹੈ ਜਿਹਨਾਂ ਦਾ ਇਲਾਜ ਉਹਨਾਂ ਦੇ ਘਰ ਵਿੱਚ ਹੋਣਾ ਸੰਭਵ ਨਹੀਂ ਹੁੰਦਾ ਹਸਪਤਾਲ ਵਿੱਚ ਖੂਨ ਪਿਸ਼ਾਬ ਥੁੱਕ ਅਤੇ ਹੋਰ ਸਾਰੇ ਟੈਸਟਾਂ ਦਾ ਵੀ ਪ੍ਰਬੰਧ ਹੁੰਦਾ ਹੈ ਰੋਗੀਆਂ ਅਤੇ ਰੋਗੀਆਂ ਦੀ ਜਾਂਚ ਦੇ ਇਲਾਜ ਲਈ ਆਧੁਨਿਕ ਮਸ਼ੀਨਾਂ ਅਤੇ ਦਵਾਈਆਂ ਵੀ ਮੌਜੂਦ ਹੁੰਦੀਆਂ ਹਨ ਜੇਕਰ ਤੁਸੀਂ ਕਿਸੇ ਵਾਡ ਵਿੱਚ ਚੱਕਰ ਲਗਾਓਂਗੇ ਤਾਂ ਤੁਹਾਨੂੰ ਉਸ ਵਿੱਚ ਬਿਸਤਰਿਆਂ ਉੱਪਰ ਪਏ ਮਰੀਜ਼ ਦਿਖਾਈ ਦੇਣਗੇ ਕਿਸੇ ਨੂੰ ਆਕਸੀਜਨ ਲੱਗੀ ਹੁੰਦੀ ਹੈ ਕਿਸੇ ਨੂੰ ਗੁਲੂਕੋਸ ਚੜ੍ਹ ਰਿਹਾ ਹੁੰਦਾ ਹੈ ਕਿਸੇ ਨੂੰ ਖੂਨ ਚੜ੍ਹ ਰਿਹਾ ਹੁੰਦਾ ਹੈ ਉਹਨਾਂ ਦੇ ਨੇੜੇ ਹੀ ਇੱਕ ਮੇਜ਼ ਦੇ ਉੱਪਰ ਦਵਾਈਆਂ ਵੀ ਪਈਆਂ ਹੁੰਦੀਆਂ ਹਨ ਇੱਕ ਜਾਂ ਇੱਕ ਤੋਂ ਵੱਧ ਡੋਕਟਰ ਅਤੇ ਕੁਝ ਨਰਸਾਂ ਸਮੇਤ ਮਰੀਜ਼ਾਂ ਦੀ ਜਾਂਚ ਕਰ ਰਹੇ ਹੁੰਦੇ ਹਨ